ਜਾਨਵਰਾਂ ਨੂੰ ਚਰਾਉਣ ਲਈ ਅੱਜ ਕੱਲ ਚਾਰ ਗਾਹਾਂ ਬਹੁਤ ਘੱਟ ਰਹਿ ਗਈਆਂ ਹਨ ਕੁਝ ਪੁਰਾਣੇ ਲੋਕ ਚਾਰ ਗਾਹਾਂ ਜਾਨਵਰਾਂ ਨੂੰ ਰੱਖਣ ਲਈ ਬਣਾਉਂਦੇ ਸਨ ਪਰ ਅੱਜ ਦੇ ਸਮੇਂ ਵਿੱਚ ਲੋਕ ਆਪਣੇ ਖਾਣ ਪਾਣ ਆਪਣੀ ਪੂਰੀ ਰੋਟੀ ਸੋਟੀ ਕਰਕੇ ਜਾਨਵਰਾਂ ਨੂੰ ਪਾਲਣਾ ਨਹੀਂ ਪਸੰਦ ਕਰਦੇ ਜਿਹੜੇ ਕਿ ਲੋਕ ਜਾਨਵਰਾਂ ਨੂੰ ਪਾਲਦੇ ਸਨ ਉਹ ਜਾਨਵਰਾਂ ਦੀ ਦੇਖਰੇਖ ਵਾਸਤੇ ਕਈ ਤਰਹਾਂ ਦੇ ਸ਼ੈਡ ਕਈ ਤਰਹਾਂ ਦੇ ਕੂਏ ਖੁਦਵਾਦੇ ਸੀ ਜਿਸ ਤੋਂ ਜਾਨਵਰ ਅੱਛੇ ਤਰੀਕੇ ਨਾਲ ਰਹਿ ਸਕੇ ਪਾਣੀ ਪੀ ਸਕੇ ਚਾਰਾਂ ਵਗੈਰਾ ਖਾ ਸਕੇ ਕੁਝ ਜਾਨਵਰ ਵਾਯੂ ਦੇ ਹਿਸਾਬ ਨਾਲ ਬਿਮਾਰ ਹੋ ਜਾਂਦੇ ਹਨ ਜਾਂ ਕਈ ਵੇਲੇ ਉਹ ਚਾਰ ਗਾਹਾਂ ਵਿੱਚ ਪਲਾਸਟਿਕ ਜਾਂ ਕੁਛ ਗੰਦ ਮੰਦ ਚਾਰੇ ਚਾਰੇ ਦੇ ਦੌਰਾਨ ਖਾ ਲੈਂਦੇ ਹਨ ਜਿਸ ਕਰਕੇ ਉਹ ਬਿਮਾਰ ਹੋ ਜਾਂਦੇ ਹਨ ਕਈ ਵਾਰ ਪਿੰਡਾਂ ਵਿੱਚ ਮਾਹੌਲ ਮੌਸਮ ਦਾ ਮਾਹੌਲ ਖਰਾਬ ਹੋਣ ਕਰਕੇ ਜਾਨਵਰ ਕਈ ਮਰ ਜਾਂਦੇ ਹਨ ਤੇ ਕੁਝ ਬਿਮਾਰ ਹੋ ਜਾਂਦੇ ਹਨ ਕਈ ਵਾਰ ਕੂਏ ਦੇ ਪਾਣੀ ਦੇ ਗੰਦੇ ਹੋਣ ਕਰਕੇ ਵੀ ਜਾਨਵਰ ਉਸਨੂੰ ਜਦੋਂ ਪੀ ਲੈਂਦੇ ਹਨ ਤੇ ਉਹਨਾਂ ਦਾ ਬਿਮਾਰ ਹੋਣਾ ਸੰਭਵ ਹੋ ਜਾਂਦਾ ਹੈ ਕੁਝ ਜਾਨਵਰ ਪਲਾਸਟਿਕ ਜਾਂ ਪਾਣੀ ਗੰਦੇ ਪਾਣੀ ਦਾ ਸੇਵਨ ਕਰਕੇ ਵੀ ਬਿਮਾਰ ਹੋ ਜਾਂਦੇ ਹਨ ਇਸ ਕਰਕੇ ਜਿਹੜੇ ਕਿ ਲੋਕ ਉਹਨਾਂ ਨੂੰ ਪਾਲਦੇ ਹਨ ਉਹਨਾਂ ਨੂੰ ਉਹਨਾਂ ਦੀ ਸਫਾਈ ਦੇ ਹਿਸਾਬ ਨਾਲ ਹਰ ਚੀਜ਼ ਸਹੀ ਉਪਲਬਧ ਕਰਨੀ ਚਾਹੀਦੀ ਹੈ ਅੱਜ ਕੱਲ ਲੋਕ ਚਾਰ ਗਾਹਾਂ ਦੇ ਵਿੱਚ ਜਾਨਵਰਾਂ ਨੂੰ ਸਹੀ ਚੀਜ਼ਾਂ ਉਪਲਬਧ ਨਹੀਂ ਕਰਦੇ ਹਨ